ਪੰਛੀਆਂ ਦੀ ਪਛਾਣ ਕਰਨਾ ਸਾਡੇ ਲਈ ਕੋਈ ਔਖਾ ਕੰਮ ਨਹੀਂ ਹੈ ਅਸੀਂ ਬਚਪਨ ਤੋਂ ਹੀ ਜ਼ਿਆਦਾਤਰ ਪੰਛੀਆਂ ਨੂੰ ਦੇਖਦੇ ਰਹੇ ਹਾਂ ਜਿਵੇਂ ਚਿੜੀਆਂ ਘੁੱਗੀਆਂ ਗਟਾਰਾਂ ਕਾਂ ਕਬੂਤਰ ਗੋਲੇ ਇੱਲ ਬਾਜ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪੰਛੀ ਦੇਖਦੇ ਹਾਂ ਜ਼ਿਆਦਾਤਰ ਪੰਛੀਆਂ ਦੀ ਸ਼ਕਲ ਜਾਂ ਰੰਗ ਰੂਪ ਤੋਂ ਉਹਨਾਂ ਦੀ ਪਹਿਚਾਣ ਹੋ ਜਾਂਦੀ ਹੈ ਜਿਵੇਂ ਕਾਂ ਬਿਲਕੁਲ ਜ਼ਿਆਦਾਤਰ ਕਾਲੇ ਰੰਗ ਦੇ ਪਾਏ ਜਾਂਦੇ ਹਨ ਅਤੇ ਤੋਤਿਆਂ ਦਾ ਰੰਗ ਹਰਾ ਹੁੰਦਾ ਹੈ ਬਾਜ ਇੱਕ ਤਿੱਖੀ ਚੁੰਝ ਵਾਲਾ ਪੰਛੀ ਹੈ ਅਤੇ ਕਾਫੀ ਆਸਮਾਨ ਦੇ ਵਿੱਚ ਉਚਾਈ 'ਤੇ ਉੱਡਦਾ ਰਹਿੰਦਾ ਹੈ ਇਹ ਆਸਮਾਨ ਦੇ ਵਿੱਚ ਉੱਡਣ ਤੋਂ ਵੀ ਨੀਚੇ ਧਰਤੀ 'ਤੇ ਦੇਖਣ ਦੀ ਸਮਰੱਥਾ ਰੱਖਦਾ ਹੈ ਇਸ ਦੀ ਨਿਗਾਹ ਕਾਫੀ ਤੇਜ਼ ਹੁੰਦੀ ਹੈ ਅਤੇ ਜਿਵੇਂ ਕਬੂਤਰ ਕਬੂਤਰਾਂ ਦਾ ਰੰਗ ਜ਼ਿਆਦਾਤਰ ਵਧੇਰੇ ਚਿੱਟਾ ਹੁੰਦਾ ਹੈ ਕਬੂਤਰਾਂ ਦੇ ਵਿੱਚ ਕਾਫੀ ਨਸਲਾਂ ਪਾਈਆਂ ਜਾਂਦੀਆਂ ਹਨ ਘੁੱਗੀਆਂ ਘੁੱਗੀਆਂ ਦਾ ਰੰਗ ਸਰਮਈ ਰੰਗ ਦਾ ਹੁੰਦਾ ਹੈ ਅਤੇ ਇਹਨਾਂ ਦੇ ਗਲ ਦੇ ਵਿੱਚ ਵੀ ਇੱਕ ਕਾਲੀ ਧਾਰੀ ਹੁੰਦੀ ਹੈ ਤੋਤੇ ਤੋਤੇ ਹਰੇ ਰੰਗ ਦੇ ਜ਼ਿਆਦਾਤਰ ਹੁੰਦੇ ਹਨ ਅਤੇ ਲਾਲ ਮੋਢੇ ਹੁੰਦੇ ਹਨ ਲਾਲ ਰੰਗ ਦੀ ਚੁੰਝ ਹੁੰਦੀ ਹੈ ਇਹਨਾਂ ਕਾਫੀ ਚੀਜ਼ਾਂ ਕਰਕੇ ਵਧੇਰੇ ਪੰਛੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ ਗਾਈਡਾਂ ਐਪਸ ਜਾਂ ਹੋਰ ਗਤੀਵਿਧੀਆਂ ਲਈ ਪੰਛੀਆਂ ਦੀ ਪਹਿਚਾਣ ਕਰਨਾ ਲਈ ਘੱਟ ਯੂਜ ਕਰਦੇ ਕੀਤੀ ਜਾਂਦੀ ਹੈ ਵਧੇਰੇ ਤਰ ਪੰਛੀਆਂ ਦੀਆਂ ਕਸਮਾਂ ਕਿਸਮਾਂ ਅਤੇ ਨਸਲਾਂ ਵੈਸੇ ਕ ਵੀ ਕਿਸਮਾਂ ਤੋਂ ਬਥੇਰੇ ਵੈਸੇ ਹੀ ਜਾਣੂ ਹਾਂ ਹੁੰਦੇ ਹਾਂ